ਹਾਂਜੀ ਜੀ ਸਤਿ ਸ਼੍ਰੀ ਅਕਾਲ ਗੱਲ ਆਪਾਂ ਪੰਜਾਬੀ ਭਾਸ਼ਾ ਦੀ ਕਰ ਰਹੇ ਹਾਂ ਕਿ ਪੰਜਾਬੀ ਭਾਸ਼ਾ ਦੇ ਵਿੱਚ ਜਿਹੜੀ ਆ ਉਹ ਆਪਾਂ ਸਾਹਿਤ ਕਵਿਤਾ ਜਾਂ ਕਲ ਕਲਾਤਮਕ ਹੋਰ ਕਈ ਤਰ੍ਹਾਂ ਦੇ ਪ੍ਰਗਟਾਵੇ ਮਤਲਬ ਕਿਵੇਂ ਕੀਤੇ ਜਾਂਦੇ ਅਤੇ ਇਹ ਭ ਭਾਸ਼ਾ ਕਿਹੋ ਜਿਹੀ ਹੈ ਪੰਜਾਬੀ ਭਾਸ਼ਾ ਜਿਹੜੀ ਹੈ ਸਾਹਿਤ ਰਚਨਾ ਵਾਸਤੇ ਕਵਿਤਾਵਾਂ ਰਚਨਾ ਵਾਸਤੇ ਜਾਂ ਹੋਰ ਕਲਾ ਕਲਾਵਾਂ ਨੂੰ ਪ੍ਰਗਟ ਕਰਨ ਵਾਸਤੇ ਜਿਹੜੀ ਆ ਉਹ ਇੱਕ ਬਹੁਤ ਹੀ ਉੱਤਮ ਭਾਸ਼ਾ ਇਹਦੇ ਵਿੱਚ ਬਹੁਤ ਸਾਰੇ ਛੰਦਾਂ ਬੈਂਤਾਂ ਅਲੰਕਾਰਾਂ ਰੂਪਕ ਅਲੰਕਾਰ ਜਿਵੇਂ ਇੱਦਾਂ ਦੇ ਦੀ ਵਰਤੋਂ ਕੀਤੀ ਜਾਂਦੀ ਹੈ ਖੁਸ਼ੀ ਨੂੰ ਗਮੀ ਨੂੰ ਮਨ ਦੀਆਂ ਭਾਵਨਾਵਾਂ ਨੂੰ ਪ੍ਰਗਟ ਕਰਨ ਲਈ ਪੰਜਾਬੀ ਭਾਸ਼ਾ ਦੇ ਵਿੱਚ ਉੱਤਮ ਦਰਜੇ ਦੀ ਜਿਹੜੀ ਆ ਉਹ ਸ਼ਬਦਾਵਲੀ ਹੈਗੀ ਹੈ ਅਤੇ ਇਹ ਇਸ ਭਾਸ਼ਾ ਨੂੰ ਜਿਹੜਾ ਵਾ ਲਿਖਣਾ ਵੀ ਬਹੁਤ ਅਸਾਨ ਹੈ ਅਤੇ ਆਪਣੀ ਲੁਪ ਲਿਪੀ ਦੇ ਵਿੱਚ ਜਿਹੜੀ ਆ ਸੰਪੂਰਨ ਮੰਨੀ ਜਾਂਦੀ ਹੈ ਠੀਕ ਹੈ ਅਤੇ ਹੁਣ ਤੱਕ ਪੰਜਾਬੀ ਸਾਹਿਤ ਬਹੁਤ ਸਾਰਾ ਪੰਜਾਬੀ ਸਾਹਿਤ ਰਚਨਾ ਜਿਹੜੀ ਹੈ ਉਹ ਸਾਡੇ ਕੋਲ ਹੈਗੀ ਆ ਉਪਲੱਬਧ ਆ ਅਤੇ ਉਹ ਸਾਹਿਤ ਜਦੋਂ ਆਪਾਂ ਵੇਖਦੇ ਹਾਂ ਕਿ ਪੰਜਾਬੀ ਵਿੱਚ ਰਚਿਆ ਗਿਆ ਹੈ ਬਹੁਤ ਸਾਰੇ ਧਾਰਮਿਕ ਗ੍ਰੰਥ ਬਹੁਤ ਸਾਰੇ ਕਵਿਤਾਵਾਂ ਠੀਕ ਹੈ ਉਹ ਪੰਜਾਬੀ ਭਾਸ਼ਾ ਵਿੱਚ ਜਿਹੜੀਆਂ ਵਾ ਉਹ ਰਚੀਆਂ ਗਈਆਂ ਵਾ ਅਤੇ ਉਹ ਨਾ ਤਾਂ ਕਿਸੇ ਨੂੰ ਸਮਝਣ 'ਚ ਕੋਈ ਮੁਸ਼ਕਿਲ ਆਈ ਹੈ ਠੀਕ ਹੈ ਅਤੇ ਨਾ ਹੀ ਕਿਸੇ ਨੇ ਉਹਨਾਂ ਨੂੰ ਮਤਲਬ ਕਿ ਨਾਪਸੰਦ ਕੀਤਾ ਉਹਨਾਂ ਨੂੰ ਬਹੁਤ ਹੀ ਵਧੀਆ ਤਰੀਕੇ ਨਾਲ ਜਿਹੜਾ ਵਾ ਸਮਾਜ ਵਿੱਚ ਲੋਕਾਂ ਦੁਆਰਾ ਪ੍ਰਵਾਣਿਆ ਗਿਆ ਵਾ ਇਸ ਲਈ ਆਪਾਂ ਜੇ ਕਹੀਏ ਕਿ ਪੰਜਾਬੀ ਭਾਸ਼ਾ ਸਾਹਿਤ ਰਚਨਾ ਲਈ ਕਵਿਤਾਵਾਂ ਦੀ ਰਚਨਾ ਲਈ ਇੱਕ ਉੱਤਮ ਭਾਸ਼ਾ ਵਾ ਤਾਂ ਇਹਦੇ ਵਿੱਚ ਕੋਈ ਵੀ ਜਿਹੜਾ ਵਾ ਉਹ ਸ਼ੱਕ ਨਹੀਂ ਹੈਗਾ ਇਹਦੇ ਵਿੱਚ ਬਹੁਤ ਸਾਰੇ ਜਿਹੜੇ ਆ ਔਰ ਬੈਂਤਾਂ ਛੰਦਾਂ ਅਲੰਕਾਰਾਂ ਦੀ ਵਰਤੋਂ ਕੀਤੀ ਜਿਨ੍ਹਾਂ ਦੇ ਨਾਲ ਇਹਨੂੰ ਇੱਕ ਅਵੱਲ ਦਰਜੇ ਦੀ ਭਾਸ਼ਾ ਹੋਣ ਦਾ ਦਰਜ ਮਾਣ ਜਿਹੜਾ ਵਾ ਉਹ ਪ੍ਰਾਪਤ ਆ ਕਿਉਂਕਿ ਇਨਸਾਨ ਹਰ ਤਰ੍ਹਾਂ ਦੇ ਆਪਣੇ ਵਿਚਾਰ ਜਿਹੜਾ ਵਾ ਇਸ ਭਾਸ਼ਾ ਵਿੱਚ ਪ੍ਰਗਟ ਕਰ ਸਕਦਾ ਹੈ ਅਤੇ ਇਹ ਮੈਂ ਤਾਂ ਇਹੀ ਕਹਾਂਗੀ ਕਿ ਪੰਜਾਬੀ ਭਾਸ਼ਾ ਇਹ ਹੈ ਇਹਨਾਂ ਸਾਹਿਤ ਕਲਾਵਾਂ ਨੂੰ ਪ੍ਰਗਟ ਕਰਨ ਵਾਸਤੇ ਇੱਕ ਉੱਤਮ ਭਾਸ਼ਾ ਵਾ ਅਤੇ ਇਹਦੇ ਵਿੱਚ ਪੰਜਾਬੀ ਭਾਸ਼ਾ ਵਿੱਚ ਹੋਰ ਵੀ ਬਹੁਤ ਕੁਛ ਸਾਹਿਤ ਰਚਨਾ ਜਿਹੜੀ ਹੈ ਉਹ ਕੀਤੀ ਜਾ ਸਕਦੀ ਹੈ ਧੰਨਵਾਦ